ਸਾਈਬਰ ਸਕਿਉਰਿਟੀ ਅੱਜ ਕੱਲ੍ਹ ਦੇ ਵਿੱਚ ਨੈਟਵਰਕਿੰਗ ਦੇ ਵਿੱਚ ਰਹਿਣ ਵਾਲਾ ਸਭ ਤੋਂ ਜ਼ਿਆਦਾ ਇਮਪੋਰਟੈਂਟ ਚੀਜ਼ ਆ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਜਿਵੇਂ ਕਿ ਆਪਾਂ ਦੇਖਦੇ ਹਾਂ ਕਿ ਜਿਹੜੇ ਸਾਈਬਰ ਧੱਕੇਸ਼ਾਹੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਲੋਕਾਂ ਦੇ ਕਾਫੀ ਹੁੰਦੇ ਨੇ ਜਦੋਂ ਇੱਕ ਵੈਬਸਾਈਟ ਤੋਂ ਦੂਜੀ ਵੈਬਸਾਈਟ ਦੇ ਉੱਪਰ ਜਾਂਦੇ ਨੇ ਤਾਂ ਉੱਥੇ ਕੀ ਹੁੰਦਾ ਕਾਫੀ ਵਾਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੀਆਂ ਬੈਂਕ ਦੀਆਂ ਡਿਟੇਲਾਂ ਪਾਓ ਉਸ ਵੈਬਸਾਈਟ ਦੇ ਉੱਪਰ ਤਾਂ ਕਿ ਤਾਂ ਉਸ ਚੀਜ਼ ਦੇ ਨਾਲ ਕੀ ਹੁੰਦਾ ਕਿ ਉਹਨਾਂ ਦਾ ਸਾਰਾ ਅਕਾਊਂਟ ਹੀ ਹੈਕ ਹੋ ਜਾਂਦਾ ਅਤੇ ਉੱਥੇ ਕੀ ਹੈ ਜਿਹੜੀ ਸਾਈਬਰ ਸਕਿਉਰਿਟੀ ਉੱਥੇ ਇਫੈਕਟ ਹੁੰਦੀ ਹੈ ਅਤੇ ਦੂਜੇ ਜੇ ਆਪਾਂ ਦੇਖਦੇ ਹਾਂ ਕਿ ਅੱਜ ਕੱਲ੍ਹ ਲੋਕ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਯੂਜ਼ ਕਰਦੇ ਹਨ ਕਾਫੀ ਲੋਕ ਜਦੋਂ ਆਪਣੀਆਂ ਕੁਛ ਵੀ ਨਵਾਂ ਸਟਾਰਟਅਪ ਕਰਦੇ ਨੇ ਤਾਂ ਲੋਕ ਕੁਛ ਲੋਕ ਕੋਈ ਚੀਜ਼ ਨੂੰ ਉਹਨੂੰ ਐਪਰੀਸ਼ੀਏਟ ਕਰਦੇ ਨੇ ਅਤੇ ਕੁਛ ਉਹਨਾਂ ਦੇ ਉੱਪਰ ਬੈਡ ਕਮੈਂਟਸ ਕਰਦੇ ਨੇ ਅਤੇ ਇਹ ਚੀਜ਼ ਆ ਜਿਹੜੀ ਲੋਕਾਂ ਦੀ ਮੈਂਟੈਲਿਟੀ ਨੂੰ ਇਫੈਕਟ ਕਰਦੀ ਆ ਅਤੇ ਇਹ ਚੀਜ਼ ਦੇ ਨਾਲ ਆਪਾਂ ਜੇ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਨੂੰ ਨਜਿੱਠਣ ਦੇ ਲਈ ਤਾਂ ਕੁਛ ਇੱਦਾਂ ਦੇ ਅਲਗੁਰਥਮਸ ਵਰਤਣੇ ਚਾਹੀਦੇ ਹਨ ਜਿੰਨਾਂ ਦੇ ਉੱਪਰ ਜਿਹੜੀ ਬੈਡ ਕਮੈਂਟਿੰਗ ਹੈ ਉਹ ਟੋਟਲੀ ਬੈਡ ਵਰਡਸ ਨੇ ਉਹ ਟੋਟਲੀ ਸਟੋਪ ਹੋ ਜਾਣ ਹੋ ਜਾਣੇ ਚਾਹੀਦੇ ਹਨ